ਨਹੀਂ ਜ਼ਿਆਦਾ ਵੱਡੇ ਪੱਧਰ 'ਤੇ ਤਾਂ ਨਹੀਂ ਮੇਰੀ ਕਲਾ ਜਿਵੇਂ ਕਿ ਪੈਂਟਿੰਗ ਵਗੈਰਾ ਵੀ ਨਹੀਂ ਮਤਲਬ ਵਰਤੇ ਗਏ ਪਰ ਹਾਂ ਸਕੂਲ ਵੀ ਜਦੋਂ ਐਗਜੀਵੀਸ਼ਨ ਸੀ ਨਾ ਉਦੋਂ ਮੇਰੇ ਬਣਾਈ ਹੋਈ ਪੈਂਟਿੰਗ ਮੈਂ ਉੱਥੇ ਰੱਖੀਆਂ ਸੀ ਅਤੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀਆਂ ਸਟੂਡੈਂਟਸ ਸੀ ਉੱਥੇ ਟੀਚਰ ਸੀ ਉਹਨਾਂ ਨੇ ਮੇਰੇ ਮੇਰੀ ਬਣਾਈ ਪੈਂਟਿੰਗ ਬਹੁਤ ਪਸੰਦ ਕੀਤੀ ਅਤੇ ਕਈਆਂ ਨੇ ਉੱਥੇ ਐਗਜੀਬਿਸ਼ਨ ਵਿੱਚ ਖਰੀਦੀਆਂ ਵੀ ਸੀ ਅਤੇ ਮੇਰੀ ਪੇਂਟਿੰਗ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਜਿਸ ਕਾਰਨ ਮੈਨੂੰ ਵੀ ਹੋਰ ਜ਼ਿਆਦਾ ਨਿਖਰਨ ਦਾ ਮੌਕਾ ਵੀ ਮਿਲਿਆ ਅਤੇ ਜ਼ਿਆਦਾ ਵੱਡੇ ਲੈਵਲ ਦਾ ਤਾਂ ਮੈਂ ਨਹੀਂ ਕਹਿ ਸਕਦੀ ਕਿ ਮੇਰੀ ਪੇਂਟਿੰਗ ਉੱਥੇ ਯੂਜ ਕੀਤੀ ਗਈ ਹੋਵੇਗੀ ਕਿਉਂਕਿ ਫਿਲਮਾਂ ਅਤੇ ਫੇਸ਼ਨ ਸੋ ਇਹ ਤਾਂ ਬਹੁਤ ਵੱਡੇ ਲੈਵਲ ਦੇ ਹੋ ਜਾਂਦੇ ਨੇ ਹਾਂ ਸਕੂਲ ਵਿੱਚ ਐਗਜੀਬਿਸ਼ਨ ਸੀ ਉੱਥੇ ਮੇਰੀਆਂ ਬਣਾਈਆਂ ਪੇਂਟਿੰਗ ਦੀ ਵਰਤੋਂ ਹੋਈ ਹੈ ਅਤੇ ਵੈਸੇ ਵੀ ਜਿਵੇਂ ਕੋਈ ਮੇਲੇ ਵਾਰ ਤਿਉਹਾਰਾਂ ਵਿੱਚ ਵੀ ਜਿਵੇਂ ਹੁੰਦੇ ਆ ਪਿੰਡ ਵਿੱਚ ਮੇਲੇ ਛੋਟੇ ਪੱਧਰ 'ਤੇ ਮੇਲੇ ਲੱਗਦੇ ਆ ਉੱਥੇ ਜਿਵੇਂ ਪੈਂਟਿੰਗ ਲਾਈ ਹੋਈ ਹੈ ਮੇਰੀ ਹਾਂ ਉਹ ਵਧੀਆ ਮਤਲਬ ਹੱਲਾਸ਼ੇਰੀ ਮਿਲੀ ਹੈ ਮੇਰੀ ਪੇਂਟਿੰਗ ਨੂੰ ਅਤੇ ਵਧੀਆ ਹੋਇਆ ਉੱਥੇ ਵੀ